ਕੱਲ੍ਹ ਮੇਰੀ ਬੇਟੀ ਦਾ ਬਰਡੇ ਸੀ ਅਤੇ ਅਸੀਂ ਸੋਚਿਆ ਕਿ ਇਸ ਵਾਰ ਬਰਡੇ ਅਸੀਂ ਘਰ ਰਹਿ ਕੇ ਹੀ ਸੈਲੀਬ੍ਰੇਟ ਕਰੀਏ ਆਪਣੇ ਸਾਰੇ ਫੈਮਲੀ ਮੈਂਬਰਸ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਇਸ ਲਈ ਅਸੀਂ ਕੀ ਕੀਤਾ ਕਿ ਅਸੀਂ ਰੈਸਟੋਰੈਂਟ ਤੋਂ ਭੋਜਨ ਮੰਗਵਾਇਆ ਜੋ ਕਿ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਹੈ ਜਿਸ ਦਾ ਨਾਮ ਹੈ ਨੂਰ ਮਹਿਲ ਇਹ ਰੈਸਟੋਰੈਂਟ ਦੋ ਤਿੰਨ ਸਾਲ ਤੋਂ ਇੱਥੇ ਖੁੱਲਿਆ ਹੈ ਅਤੇ ਇਸ ਦਾ ਖਾਣਾ ਇੰਨਾ ਜ਼ਿਆਦਾ ਸਵਾਦਿਸ਼ਟ ਹੈ ਕਿ ਜਿਸ ਵਿੱਚ ਹਰੇਕ ਤਰ੍ਹਾਂ ਦੇ ਮਸਾਲੇ ਪੂਰੇ ਸਹੀ ਤਰੀਕੇ ਨਾਲ ਪਾਏ ਹੁੰਦੇ ਨੇ ਨਾ ਤਾਂ ਉਹ ਜ਼ਿਆਦਾ ਹੁੰਦੇ ਨੇ ਜ਼ਿਆਦਾ ਮਾਤਰਾ ਵਿੱਚ ਨਾ ਜ਼ਿਆਦਾ ਘੱਟ ਹੁੰਦੇ ਨੇ ਅਤੇ ਖਾਣਾ ਇੰਨਾ ਜ਼ਿਆਦਾ ਸਵਾਦਿਸ਼ਟ ਹੁੰਦਾ ਜਿੱਦਾਂ ਕਿ ਘਰ ਦਾ ਖਾਣਾ ਹੁੰਦਾ ਹੈ ਅਤੇ ਸਾਰੇ ਹੀ ਪਰਿਵਾਰਿਕ ਮੈਂਬਰਾਂ ਨੂੰ ਇਸ ਰੈਸਟੋਰੈਂਟ ਦਾ ਖਾਣਾ ਇੰਨਾ ਜ਼ਿਆਦਾ ਸਵਾਦਿਸ਼ਟ ਲੱਗਿਆ ਕਿ ਸਾਰੇ ਉਂਗਲਾਂ ਚੱਖਦੇ ਰਹਿ ਗਏ ਅਤੇ ਇਹਨਾਂ ਦੀ ਡਿਲੀਵਰੀ ਸਰਵਿਸ ਵੀ ਇਹ ਪ੍ਰੋਵਾਈਡ ਕਰਦੇ ਨੇ ਖਾਣਾ ਪੰਜ ਤੋਂ ਦਸ ਮਿੰਟ ਦੇ ਵਿੱਚ ਤੁਹਾਡੇ ਘਰ ਪਹੁੰਚਾ ਦਿੰਦੇ ਨੇ ਅਤੇ ਮਾਤਰਾ ਵੀ ਅੱਛੀ ਆ ਖਾਣੇ ਦੀ ਅਤੇ ਮੈਂ ਤਾਂ ਇਹੀ ਸੁਝਾਅ ਦਉਂਗੀ ਆਪਣੇ ਦੋਸਤਾਂ ਨੂੰ ਅਤੇ ਮਿੱਤਰਾਂ ਨੂੰ ਕਿ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਫੰਕਸ਼ਨ ਜਾਂ ਪ੍ਰੋਗਰਾਮ ਰੱਖਿਆ ਹੁੰਦਾ ਜਦੋਂ ਤੁਸੀਂ ਨਹੀਂ ਖਾਣਾ ਬਣਾ ਸਕਦੇ ਜਾਂ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਤੁਸੀਂ ਘਰ ਦੇ ਖਾਣੇ ਦਾ ਅਨੰਦ ਨੂਰ ਮਹਿਲ ਰੈਸਟੋਰੈਂਟ ਤੋਂ ਖਾਣਾ ਮੰਗਵਾ ਕੇ ਕਰ ਸਕਦੇ ਹੋ